ਭੰਗੜੇ ਅਤੇ ਪਹਿਰਾਵਾ ਕੁੜਤਾ ਚਾਦਰਾ ਕੈਂਠਾਂ ਤੁਰਲੇ ਵਾਲੀ ਪੱਗ ਜੁੱਤੀ ਇਹ ਪੰਜਾਬੀ ਭੰਗੜਾ ਔਰਤਾਂ ਲਈ ਪੰਜਾਬੀ ਸੂਟ ਫੁਲਕਾਰੀ ਪੰਜਾਬੀ ਜੁੱਤੀ ਇਹਦੇ ਨਾਲ ਬਹੁਤ ਸੋਹਣੀਆ ਔਰਤਾਂ ਲੱਗਦੀਆਂ ਹਨ ਜੇ ਆਪਾਂ ਜਾਣੀਏ ਪੰਜਾਬ ਵਿੱਚ ਭੰਗੜਾ ਬਹੁਤ ਮਸ਼ਹੂਰ ਹੈ ਪੰਜਾਬਣਾਂ ਵਾਸਤੇ ਇਹ ਬਹੁਤ ਵਧੀਆ ਭੰਗੜਾ ਪੈਂਦਾ ਹੈ ਅਤੇ ਗਿੱਧਾ ਪੈਂਦਾ ਹੈ